ਸਾਡੇ ਖੇਤਰ ਦੇ ਜਿਹੜੇ ਵੱਖ ਵੱਖ ਮੌਸਮ ਆ ਉਹ ਪੰਜਾਬ ਦੇ ਵਿੱਚ ਮੌਸਮ ਗਰਮੀ ਸਰਦੀ ਵਾਲਾ ਮੌਸਮ ਪੂਰੇ ਅੱਤ ਲੈਵਲ ਤੱਕ ਹੈ ਜਿਹੜਾ ਉਹ ਜਾਂਦਾ ਕਿਉਂਕਿ ਗਰਮੀ ਦੇ ਮਹੀਨਿਆਂ ਦੇ ਵਿੱਚ ਮੰਨ ਲਓ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਮਈ ਜੂਨ ਦੇ ਵਿੱਚ ਜਿਹੜੀ ਬਹੁਤ ਸਾਰੀ ਗਰਮੀ ਅੱਤ ਦੀ ਗਰਮੀ ਜਾਂ ਜਿਹੜੀਆਂ ਗਰਮ ਹਵਾਵਾਂ ਨੇ ਜਿਨ੍ਹਾਂ ਨੂੰ ਲੂ ਕਿਹਾ ਜਾਂਦਾ ਤਾਂ ਉਹ ਵੀ ਜਿਹੜੀ ਬਹੁਤ ਇਸ ਸਮੇਂ ਦੇ ਵਿੱਚ ਚਲਦੀ ਹੈ ਤਾਂ ਉਹਦੇ ਕਾਰਨ ਜਿਹੜੀ ਬਾਹਰਲੀ ਤਪਸ਼ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਸ ਇਸ ਤਰ੍ਹਾਂ ਸਰਦੀ ਦੇ ਵਿੱਚ ਖਾਸਕਰ ਦਸੰਬਰ ਅਤੇ ਜਨਵਰੀ ਦੋ ਮਹੀਨਿਆਂ ਦੇ ਵਿੱਚ ਬਹੁਤ ਅੱਤ ਦੀ ਜਿਹੜੀ ਸਰਦੀ ਆ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪੱਤਝੜ ਅਤੇ ਬਸੰਤ ਜਿਹੜੀਆਂ ਰੁੱਤਾਂ ਨੇ ਇਨ੍ਹਾਂ ਦਾ ਵੀ ਜਿਹੜਾ ਚੰਗਾ ਪ੍ਰਭਾਵ ਹੈ ਜਾਂ ਉਹ ਸਾਹਮਣੇ ਆਉਂਦਾ ਦੇਖਣ ਨੂੰ ਮਿਲਦਾ ਤਾਂ ਇਨ੍ਹਾਂ ਮੌਸਮਾਂ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜ਼ਰੂਰ ਜਿਹੜਾ ਬਦਲਾਵ ਆ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਜੇਕਰ ਕੁਦਰਤ ਦਾ ਨਿਯਮ ਆ ਜਿਹੜਾ ਉਹ ਹੈਗਾ ਛੇ ਮਹੀਨੇ ਗਰਮੀ ਦਾ ਸਾਲ ਦੇ ਵਿੱਚ ਅਤੇ ਛੇ ਮਹੀਨੇ ਜਿਹੜਾ ਠੰਢ ਦਾ ਜਾਂ ਜਿਹੜੀ ਜ਼ਿਆਦਾ ਠੰਢ ਆ ਉਹ ਦੋ ਦੋ ਤਿੰਨ ਤਿੰਨ ਮਹੀਨੇ ਜਾਂ ਗਰਮੀ ਦੋ ਤਿੰਨ ਮਹੀਨੇ ਤਾਂ ਉਸ ਤੋਂ ਬਾਅਦ ਜਿਹੜਾ ਪੱਤਝੜ ਅਤੇ ਜਿਵੇਂ ਬਸੰਤ ਦੇ ਮੌਸਮ ਉਹਨਾਂ ਵਿੱਚ ਜਿਹੜਾ ਇੱਕ ਸਮਤਲ ਜਾਂ ਸਮਤੋੜ ਜਿਹੜਾ ਇੱਕ ਮੌਸਮ ਉਹ ਬਣਿਆ ਰਹਿੰਦਾ ਪੰਜਾਬ ਦੇ ਵਿੱਚ ਤਾਂ ਜਿਹੜੀ ਸਰਦੀ ਸ਼ੁਰੂ ਹੋਣ ਦੇ ਪਹਿਲਾਂ ਜਿਹੜੇ ਮਹੀਨੇ ਸੀਗੇ ਖਾਸਕਰ ਸਤੰਬਰ ਤੋਂ ਸਰਦੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਸੀ ਤਾਂ ਹੁਣ ਕੀ ਹੈ ਕਿ ਸਰਦੀ ਜਿਹੜੀ ਉਹ ਜਨਵਰੀ ਤੱਕ ਅੱਗੇ ਖਤਮ ਹੋ ਜਾਂਦੀ ਸੀ ਪਰ ਹੁਣ ਜਿਹੜੀ ਸਰਦੀ ਹੈ ਉਹ ਖਾਸਕਰ ਦਸੰਬਰ ਤੋਂ ਸ਼ੁਰੂ ਹੁੰਦੀ ਹੈ ਅਤੇ ਉਹ ਅੱਗੇ ਫਰਵਰੀ ਤੱਕ ਮਾਰਚ ਤੱਕ ਜਿਹੜੀ ਚੱਲੀ ਜਾਂਦੀ ਆ ਜਿਹੜੀ ਜ਼ਿਆਦਾ ਸਰਦੀ ਆ ਇਸ ਤਰ੍ਹਾਂ ਗਰਮੀ ਜਿਹੜੀ ਕਿ ਜੂਨ ਜੁਲਾਈ ਦੇ ਵਿੱਚ ਜ਼ਿਆਦਾ ਹੁੰਦੀ ਸੀ ਪਰ ਕਈ ਵਾਰ ਗਰਮੀ ਜਿਹੜੀ ਉਹ ਜ਼ਿਆਦਾ ਸਮਾਂ ਰਹਿ ਜਾਂਦੀ ਆ ਸਾਲ ਦੇ ਵਿੱਚ ਜਿਵੇਂ ਅਪ੍ਰੈਲ ਤੋਂ ਬਹੁਤ ਤੇਜ਼ ਗਰਮੀ ਸ਼ੁਰੂ ਹੋ ਕੇ ਜਿਹੜੀ ਪੰਜ ਛੇ ਮਹੀਨੇ ਜਿਹੜੀ ਲਗਾਤਾਰ ਗਰਮੀ ਜਿਹੜੀ ਉਹ ਰਹਿ ਜਾਂਦੀ ਹੈ